ਭੰਗੜਾ ਐਰੋਬਿਕਸ ਲਈ ਮੇਰੇ ਮਨ ਪਸੰਦ ਗੀਤ ਉਹ ਹਨ ਜਿਹੜੇ ਢੋਲ ਦੀ ਤਾਲ ਨਾਲ ਭਰੇ ਹੋਏ ਅਤੇ ਜਿਹਨਾਂ ਵਿੱਚ ਬਹੁਤ ਜ਼ਿਆਦਾ ਜੋਸ਼ ਹੋਵੇ ਮੈਨੂੰ ਉਹ ਗੀਤ ਪਸੰਦ ਹਨ ਜੋ ਮੈਨੂੰ ਨੱਚਣ ਲਈ ਮਜਬੂਰ ਕਰਦੇ ਹਨ ਅਤੇ ਮੇਰੇ ਅੰਦਰ ਦੀ ਊਰਜਾ ਨੂੰ ਬਾਹਰ ਕੱਢਦੇ ਹਨ ਮੇਰੀ ਲਿਸਟ ਵਿੱਚ ਕੁਝ ਪੁਰਾਣੇ ਅਤੇ ਕੁਝ ਨਵੇਂ ਗੀਤ ਸ਼ਾਮਿਲ ਹਨ ਜਿਵੇਂ ਕਿ ਗੁਰਦਾਸ ਮਾਨ ਜੀ ਦੇ ਗੀਤ ਜਿਹਨਾਂ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ ਹੈ ਅਤੇ ਜੋ ਸਾਨੂੰ ਆਪਣੇ ਸੱਭਿਆਚਾਰ ਨਾਲ ਜੋੜਦੇ ਹਨ ਫਿਰ ਆਉਂਦੇ ਹਨ ਦਲੇਰ ਮਹਿੰਦੀ ਦੇ ਗੀਤ ਜਿਹਨਾਂ ਦੀ ਊਰਜਾ ਸਾਨੂੰ ਨੱਚਣ ਲਈ ਉਤਸਾਹਿਤ ਕਰਦੀ ਹੈ ਨਵੇਂ ਗੀਤਾਂ ਵਿੱਚ ਮੈਨੂੰ ਦਿਲਜੀਤ ਦੋਸਾਂਝ ਅਤੇ ਐਮੀ ਵਿਰਕ ਦੇ ਗੀਤ ਬਹੁਤ ਪਸੰਦ ਹਨ ਉਹਨਾਂ ਦੇ ਗੀਤਾਂ ਨ ਵਿੱਚ ਨਾ ਸਿਰਫ ਊਰਜਾ ਹੁੰਦੀ ਹੈ ਸਗੋਂ ਸਾਨੂੰ ਇੱਕ ਆਧੁਨਿਕ ਟੱਚ ਵੀ ਮਿਲਦਾ ਜੋ ਉਹਨਾਂ ਨੂੰ ਹੋਰ ਵੀ ਮਜ਼ੇਦਾਰ ਬਣਾਉਂਦਾ ਮੈਨੂੰ ਉਹ ਗੀਤ ਪਸੰਦ ਹਨ ਜਿਹੜਾ ਫੋਕ ਅਤੇ ਪੋਪ ਦਾ ਮਿਸ਼ਰਣ ਹੋਵੇ ਇਹ ਗੀਤ ਭੰਗੜਾ ਐਰੋਬਿਕਸ ਲਈ ਬਿਲਕੁਲ ਸਹੀ ਹਨ ਕਿਉਂਕਿ ਇਹ ਤੁਹਾਨੂੰ ਨਾ ਸਿਰਫ ਨੱਚਣ ਲਈ ਉਤਸਾਹਿਤ ਕਰਦੇ ਹਨ ਸਗੋਂ ਇਹ ਤੁਹਾਡੇ ਦਿਲ ਨੂੰ ਵੀ ਖੁਸ਼ ਕਰਦੇ ਹਨ ਮੇਰੇ ਹਿਸਾਬ ਨਾਲ ਤਾਂ ਭੰਗੜਾ ਐਰੋਬਿਕਸ ਲਈ ਸਭ ਤੋਂ ਵਧੀਆ ਗੀਤ ਉਹੀ ਹਨ ਜੋ ਕਿ ਤੁਹਾਨੂੰ ਖੁਸ਼ ਕਰਦੇ ਹਨ ਤੁਹਾਨੂੰ ਨੱਚਣ ਲਈ ਮਜਬੂਰ ਕਰਦੇ ਹਨ ਜਿਹਨਾਂ ਨੂੰ ਸੁਣ ਕੇ ਬਸ ਤੁਸੀਂ ਨੱਚਣਾ ਚਾਹੁੰਦੇ ਹੋ ਅਤੇ ਤੁਹਾਨੂੰ ਪ੍ਰੇਰਿਤ ਕਰਦੇ ਹਨ ਇਸ ਲਈ ਆਪਣੀ ਪਲੇਲਿਸਟ ਬਣਾਓ ਅਤੇ ਭੰਗੜਾ ਐਰੋਬਿਕਸ ਦਾ ਆਨੰਦ ਮਾਣੋ